ਭਾਰਤੀ ਫਿਲਮਾਂ ਦੇ ਬਾਰੇ ਜੇ ਗੱਲ ਕਰੀਏ ਉਹਨਾਂ ਦੇ ਸੰਗੀਤ ਬਾਰੇ ਗੱਲ ਕਰੀਏ ਤਾਂ ਪੂਰੀ ਦੁਨੀਆ 'ਚ ਸਾਨੂੰ ਇੱਕ ਅਲੱਗ ਪਹਿਚਾਣ ਦਿੰਦੇ ਹੈ ਸਾਨੂੰ ਬਹੁਤ ਦੂਰ ਤੱਕ ਲੈ ਕੇ ਜਾਂਦੇ ਆ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਜਿਵੇਂ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਜੀ ਬੜਾ ਪਸੰਦ ਹੈ ਆਮ ਤੌਰ 'ਤੇ ਮੈਂ ਪੰਜਾਬੀ ਕਮੇਡੀ ਫਿਲਮਾਂ ਦੇਖਣੀਆਂ ਬੜੀਆਂ ਚੰਗੀਆਂ ਲੱਗਦੀਆਂ ਅੱਜ ਕੱਲ੍ਹ ਇਨ੍ਹਾਂ ਦੇ ਮਿਊਂਜਿਕ ਬੜੇ ਹਾਈ ਲੈਵਲ ਦੇ ਬਣਨ ਲੱਗ ਗਏ ਬਹੁਤ ਜ਼ਿਆਦਾ ਉੱਚ ਪੱਧਰੀ ਹੋ ਗਏ ਬੜਾ ਚੰਗਾ ਲੱਗਦਾ ਉਹ ਵੀ ਅਤੇ ਕਾਫ਼ੀ ਜ਼ਿਆਦਾ ਪਸੰਦ ਫਿਲਮਾਂ ਸਿਰਫ਼ ਮੈਨੂੰ ਕਮੇਡੀ ਹੀ ਆਉਂਦੀਆਂ ਜਸਵਿੰਦਰ ਭੱਲਾ ਜੀ ਹੋ ਗਏ ਬੀਨੂ ਢਿੱਲੋਂ ਹੋ ਗਏ ਦਲਜੀਤ ਦੋਸਾਂਝ ਹੋ ਗਿਆ ਇਹਨਾਂ ਦੇ ਵਧੀਆ ਲੱਗਦੇ ਮੈਨੂੰ ਅਦਾਕਾਰੀ ਵੀ ਚੰਗੀ ਲੱਗਦੀ ਆ ਕਾਫ਼ੀ ਅੱਛੀ ਕਮੇਡੀ ਹੁੰਦੀ ਇਨ੍ਹਾਂ ਦੀ ਅਤੇ ਫਿਲਮਾਂ ਇੱਕ ਮੈਸੇਜ਼ ਦੇ ਕੇ ਜਾਂਦੀਆਂ ਸਮਾਜ ਨੂੰ ਜਿਸ ਤਰ੍ਹਾਂ ਕ ਤੁਹਾਡੀ ਇੱਕ ਆਹ ਫਿਲਮ ਆਈ ਹੈ ਗੋਡੇ ਗੋਡੇ ਚਾਅ ਇੱਕ ਔਰਤਾਂ ਅਤੇ ਪੁਰਾਣੇ ਸਮਾਜ ਨੂੰ ਦਰਸਾਉਂਦੀ ਹੈ ਅਤੇ ਉਹਦੇ ਬਾਰੇ ਉਨ੍ਹਾਂ ਨੇ ਗੱਲ ਕਰੀ ਹੈ ਕਾਫ਼ੀ ਚੰਗਾ ਲੱਗਿਆ ਉਹਦੇ 'ਚ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਨਾ ਜਿਹੜੀਆਂ ਮੈਸਿਜ਼ ਦੇ ਦਿੰਦੀਆਂ ਸੁਨੇਹਾ ਦੇ ਕੇ ਜਾਂਦੀਆਂ ਸਮਾਜ ਨੂੰ ਉਹ ਬੜਾ ਚੰਗਾ ਲੱਗਦਾ ਉਹ ਬਾਕੀ ਗਾਣੇ ਮਿਉਜਿਕ ਜਾਂ ਕੁਛ ਵੀ ਹੋ ਗਿਆ ਖਾਸ ਕੁਛ ਖਾਸ ਨਹੀਂ ਇਹ ਸਾਰੇ ਹੀ ਪਸੰਦ ਹੈ ਹਰੇਕ ਦੇ ਵਧੀਆ ਲੱਗਦਾ ਸਭ ਠੀਕ ਲੱਗਦਾ